ਨਿਊਜ਼ ਮੀਡੀਆ ਦੌਰਾਨ ਸਾਨੂੰ ਵਿਦਿਆਰਥੀਆਂ ਨੂੰ ਮਦਦ ਹੁੰਦੀ ਹੈ ਜੋ ਕਿ ਸੰਸਾਰ ਵਿੱਚ ਪੂਰੇ ਭਾਰਤ ਵਿੱਚ ਹੋ ਰਿਹਾ ਏ ਇਸ ਕਰਕੇ ਇਹ ਸਾਨੂੰ ਨਿਊਜ਼ ਮੀਡੀਆ ਰਾਹੀਂ ਪਤਾ ਚੱਲਦਾ ਹੈ ਜਿਵੇਂ ਕੀ ਰਾਜਪਾਲ ਕੌਣ ਹੈ ਮੁੱਖ ਮੰਤਰੀ ਕੌਣ ਹੈ ਪ੍ਰਧਾਨ ਮੰਤਰੀ ਕੌਣ ਹੈ ਕਿਹੜਾ ਖਿਡਾਰੀ ਕਿੰਨਵੇਂ ਨੰਬਰ 'ਤੇ ਹੈ ਇਹ ਸਾਰਾ ਸਾਨੂੰ ਨਿਊਜ਼ ਮੀਡੀਆ 'ਤੇ ਤੋਂ ਹੀ ਪਤਾ ਚੱਲਦਾ ਹੈ ਅਤੇ ਨਿਊਜ਼ ਮੀਡੀਆ ਇੱਕ ਇਹਾ ਇਹਾ ਜਿਹਾ ਚੈਨਲ ਹੈ ਨਿਊਜ਼ ਮੀਡੀਆ ਹਰੇਕ ਦੀ ਮਦਦ ਕਰਦਾ ਏ ਇਹ ਗਰੀਬਾਂ ਦੀ ਵੀ ਮਦਦ ਕਰਦਾ ਅਤੇ ਅਮੀਰਾਂ ਦੀ ਵੀ ਮਦਦ ਕਰਦਾ ਹੈ ਇਸ ਕਰਕੇ ਨਿਊਜ਼ ਮੀਡੀਆ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਕਿ ਇਹ ਨਿਊਜ਼ ਮੀਡੀਆ ਇੱਦਾਂ ਹੀ ਅੱਗੇ ਮਦਦ ਕਰਿਆ ਕਰੇ ਕਿਉਂਕਿ ਸਾਨੂੰ ਵੀ ਪਤਾ ਚੱਲ ਸਕੇ ਇਹਨਾਂ ਤੋਂ ਕਿ ਸਾਡੇ ਦੇਸ਼ ਵਿੱਚ ਕੀ ਕੀ ਹੋ ਰਿਹਾ ਏ ਅਤੇ ਸਾਨੂੰ ਇਸ ਕਰਕੇ ਨਿਊਜ਼ ਮੀਡੀਆ ਵਿੱਚ ਜੀ ਕੇ ਦੇ ਕੋਸ਼ਨ ਵੀ ਆਉਂਦੇ ਹਨ ਜੋ ਕਿ ਸਾਨੂੰ ਇਸ ਬਾਰੇ ਨੋਲੇਜ ਵੱਧਦੀ ਹੈ ਅਤੇ ਜਾਣਕਾਰੀ ਵੱਧਦੀ ਏ